ਹਾਈਕਿੰਗ ਕਰਨ ਲਈ ਮੇਰਾ ਮਨਪਸੰਦ ਇਲਾਕਾ ਪਹਾੜ ਅਤੇ ਜੰਗਲ ਹਨ ਪਹਾੜ ਬਹੁਤ ਹੀ ਲੰਬੇ ਹੁੰਦੇ ਹਨ ਅਤੇ ਰੋਮਾਂਚਕ ਹੁੰਦੇ ਹਨ ਭਾਵੇਂ ਪਹਾੜਾਂ ਦੇ ਰਸਤੇ ਡਰਾਵਨੇ ਵੀ ਹੁੰਦੇ ਹਨ ਪਰ ਹਾਈਕਿੰਗ ਕਰਨ ਦਾ ਅਲੱਗ ਹੀ ਨਜ਼ਾਰਾ ਹੁੰਦਾ ਹੈ ਪਹਾੜਾਂ ਦੇ ਰਸਤਿਆਂ ਵਿੱਚ ਤੁਹਾਨੂੰ ਬਹੁਤ ਕੁਛ ਅਨੁਭਵ ਕਰਨ ਨੂੰ ਮਿਲਦਾ ਹੈ ਪਹਾੜਾਂ ਵਿੱਚ ਹਾਈਕਿੰਗ ਕਰਨ ਦਾ ਆਪਣਾ ਹੀ ਆਨੰਦ ਹੈ ਤੁਸੀਂ ਪਹਾੜਾਂ ਵਿੱਚ ਹਾਈਕਿੰਗ ਕਰਦੇ ਸਮੇਂ ਬਹੁਤ ਕੁਝ ਅਨੁਭਵ ਵੀ ਕਰਦੇ ਹੋ ਪਹਾੜਾਂ ਵਿੱਚ ਜਾ ਕੇ ਤੁਸੀਂ ਬਹੁਤ ਹੀ ਅਲੌਕਿਕ ਨਜ਼ਾਰੇ ਦੇਖਦੇ ਹੋ ਉੱਥੇ ਬਹੁਤ ਹੀ ਜ਼ਿਆਦਾ ਅਲੌਕਿਕ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਜੋ ਕਿ ਕਦੇ ਤੁਸੀਂ ਦੇਖੇ ਨਾ ਹੋਣ